ਮੈਂ ਪੰਜਾਬੀ ਸੱਭਿਆਚਾਰ ਨਾਲ ਸੰਬੰਧ ਰੱਖਦਾ ਹਾਂ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਗੱਭਰੂਆਂ ਲਈ ਜਿਵੇਂ ਚਾਦਰੇ ਕੁੜਤੇ ਕੈਂਠੇ ਅਤੇ ਉਹਨਾਂ ਲੀਨ ਦੀਆਂ ਵੰਨ ਸੁਵੰਨੀਆਂ ਪੱਗਾਂ ਅਤੇ ਐਵੇਂ ਹੀ ਮੁਟਿਆਰਾਂ ਲਈ ਪਰਾਂਦੇ ਫੁਲਕਾਰੀ ਵਾਲੀਆਂ ਚੁੰਨੀਆਂ ਠੀਕ ਹੈ ਸੱਗੀ ਫੁੱਲ ਇਹ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਨੇ ਪਹਿਰਾਵੇ ਮਤਲਵ ਪੰਜਾਬ 'ਚ ਪਾਏ ਜਾਂਦੇ ਨੇ